ਪੰਜਾਬ ਵਿੱਚ ਕਈ ਸਿਆਸੀ ਪਾਰਟੀਆਂ ਹਨ ਪਰ ਉਹਨਾਂ ਵਿੱਚੋਂ ਮੁੱਖ ਤਿੰਨ ਹੀ ਪਾਰਟੀਆਂ ਹਨ ਜਿਹਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਅਤੇ ਬੀ ਜੇ ਪੀ ਕਹਿ ਸਕਦੇ ਹਾਂ ਹਰ ਇੱਕ ਪਾਰਟੀ ਆਪਣੇ ਆਪਣੇ ਹਿਸਾਬ ਨਾਲ ਆਪਣਾ ਆਪਣਾ ਅਧਿਕਾਰ ਬਣਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਪੋਲੀਟਿਕਸ ਹੈ ਹੀ ਪੋਲੀਟਿਕਸ ਇਸ ਵਿੱਚ ਹਰ ਸਿਆਸਤਦਾਨ ਆਪਣੀ ਆਪਣੀ ਸਿਆਸਤ ਵਰਤ ਕੇ ਸਿਆਸਤ ਵਿੱਚ ਆਉਣ ਦੀ ਕੌਸ਼ਿਸ਼ ਕਰਦਾ ਰਹਿੰਦਾ ਹੈ ਪਰ ਹਰ ਸਿਆਸਤਦਾਨ ਨੂੰ ਪਬਲਿਕ ਬਾਰੇ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ ਸਿਰਫ਼ ਆਪਣਾ ਮਤਲਬ ਨਹੀਂ ਕੱਢਣਾ ਚਾਹੀਦਾ ਕਿਉਂਕਿ ਡੈਮੋਕਰੇਟਿਕ ਕੰਟਰੀ ਭਾਰਤ ਵਿੱਚ ਵੋਟਾਂ ਦੇ ਜ਼ਰੀਏ ਹੀ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪੁੱਜਦੀ ਹੈ